ਬਾਲ ਮਜ਼ਦੂਰੀ ਬਾਲ ਮਜ਼ਦੂਰੀ ਇਸ ਕਰਕੇ ਜ਼ਿਆਦਾ ਪ੍ਰਫੁਲਿਤ ਹੋ ਰਹੀ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਪੜ੍ਹਾਈ ਲਿਖਾਈ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ ਜਿਸ ਕਾਰਨ ਉਹ ਘਰ ਆਪਣੇ ਮਾਪਿਆਂ ਨੂੰ ਤੰਗ ਕਰਦੇ ਹਨ ਮਾਪਿਆਂ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਹਨ ਹਰ ਵੇਲੇ ਮੋਬਾਇਲ ਫੋਨ ਦੇ ਵਿੱਚ ਵੜੇ ਰਹਿੰਦੇ ਹਨ ਜਿਸ ਕਾਰਨ ਘਰ ਦੇ ਉਹਨਾਂ ਨੂੰ ਕਹਿੰਦੇ ਹਨ ਜ ਜਾਂ ਤਾਂ ਪੜ੍ਹਾਈ ਲਿਖਾਈ ਕਰ ਲੈ ਜਾਂ ਤੈਨੂੰ ਕਿਸੇ ਕੰਮ ਲਗਵਾ ਦੇਣਾ ਇੱਕ ਇੱਕ ਤਾਂ ਕਾਰਨ ਇਹ ਵੀ ਹੈ ਦੂਸਰਾ ਕਾਰਨ ਵੀ ਹੈ ਕਿ ਕਸਬਿਆਂ ਦੇ ਵਿੱਚ ਜਿਹੜੇ ਲੋਕ ਜਿਹੜੇ ਬੱਚੇ ਹਨ ਪਿੰਡ ਸ਼ਹਿਰ ਵਿੱਚ ਜਿਹੜੇ ਬੱਚੇ ਹਨ ਉਹਨਾਂ ਨੂੰ ਅੱਜ ਕੱਲ੍ਹ ਪੈਸਿਆਂ ਦੇ ਮਗਰ ਜਾਣ ਦੀ ਅ ਜਾਣ ਦੀ ਲੱਗੀ ਹੋਈ ਹੈ ਜਿਸ ਕਾਰਨ ਉਹ ਜ਼ਿਆਦਾਤਰ ਕਹਿੰਦੇ ਹਨ ਕਿ ਅਸੀਂ ਫਟਾਫਟ ਪੈਸੇ ਕਮਾ ਲਈਏ ਪੜ੍ਹਾਈ ਲਿਖਾਈ ਵਿੱਚ ਕੁਝ ਨਹੀਂ ਰੱਖਿਆ ਹੋਇਆ ਕਾਫੀ ਸਾਰੇ ਇੱਦਾਂ ਦੇ ਕੰਮ ਹਨ ਜਿਨ੍ਹਾਂ ਵਿੱਚ ਬੱਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਚਾਏ ਦੀਆਂ ਛੋਟੀ ਮੋਟੀ ਸ਼ੋਪਸ ਹੁੰਦੀਆਂ ਹਨ ਦੁਕਾਨਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਬ ਭਾਂਡੇ ਧੋਣ 'ਚ ਜਾਂ ਕ ਚਾਹ ਬਣਾਉਣ ਵਿੱਚ ਲਗਾਇਆ ਜਾ ਸਕਦਾ ਹੈ ਹੋਰ ਵੀ ਕਈ ਇੱਦਾਂ ਦੇ ਕੰਮ ਹਨ ਜਿਥੇ ਛੋਟੀਆਂ ਮੋਟੀਆਂ ਸ਼ੋਪ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਬੱਚਿਆਂ ਨੂੰ ਕੁਛ ਨਾ ਕੁਛ ਕੰਮ 'ਤੇ ਲਗਾਇਆ ਜਾ ਲਗਾਇਆ ਜਾ ਸਕਦਾ ਹੈ ਬਟ ਇਹ ਪਰ ਮੇ ਮੇਰੇ ਮੇਰੇ ਨ ਮੇਰੇ ਅਕੋਡਿੰਗ ਇਹ ਕੰਮ ਬਿਲਕੁਲ ਨਹੀਂ ਸਹੀ ਹੈਗਾ ਜਿੱਥੇ ਸਾਡਾ ਅੱਜ ਅੱਜ ਦਾ ਨੌਜਵਾਨ ਪੜ੍ਹਾਈ ਲਿਖਾਈ ਨੂੰ ਛੱਡ ਕੇ ਇਹੋ ਜਿਹੇ ਰਾਹ ਪੈ ਗਿਆ ਹੈ ਅਤੇ ਉੱਥੇ ਸਾਡਾ ਫਿਊਚਰ ਸਾਡਾ ਜਿਹੜਾ ਭਵਿੱਖ ਹੈ ਉਹ ਕਿਸ ਪਾਣੀ ਵਿੱਚ ਜਾਏਗਾ ਇਸ ਲਈ ਸਾਨੂੰ ਬਾਲ ਮਜ਼ਦੂਰੀ ਨੂੰ ਜਿੰਨਾ ਹੋ ਸਕੇ ਉੱਨਾ ਹੀ ਕੰਟਰੋਲ 'ਚ ਜਾਂ ਉੱਨਾ ਹੀ ਰੋਕਣਾ ਸ ਰੋਕਣਾ ਚਾਹੀਦਾ ਹੈ ਬਾਲ ਮਜ਼ਦੂਰੀ ਸਾਡੇ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਜ਼ਿਆਦਾਤਰ ਬੱਚੇ ਸਕੂਲਾਂ ਵਿੱਚ ਨਾ ਜਾ ਕੇ ਇਹੋ ਜਿਹੇ ਕੰਮਾਂ ਵਿੱਚ ਜ਼ਿਆਦਾ ਪੈ ਰਹੇ ਹਨ ਜਿਸ ਕਾਰਨ ਸਿੱਖਿਆ ਦੇ ਖੇਤਰ ਵਿੱਚ ਕਾਫੀ ਘਾਟ ਆ ਰਹੀ ਹੈ ਸਰਕਾਰ ਨੂੰ ਇਸ ਲਈ ਸਰਕਾਰ ਨੇ ਇਸ ਲਈ ਕਾਫੀ ਕਦਮ ਚੁੱਕੇ ਹਨ ਕਿ ਅੱਜ ਕੱਲ੍ਹ ਕਾਫੀ ਘੱਟ ਗਈ ਹੈ ਬਲ ਬਾਲ ਮਜ਼ਦੂਰੀ ਪੁਲਿਸ ਤੇ ਡਰ ਤੋਂ ਅਤੇ ਹੋਰ ਸਰਕਾਰ ਦੇ ਡਰ ਤੋਂ ਪਰ ਕਿੱਥੇ ਨਹੀਂ ਹਰ ਕਿਤੇ ਇਸ 'ਤੇ ਰੋਕ ਨਹੀਂ ਲੱਗੀ ਹੈ ਸਾਨੂੰ ਸਾਨੂੰ ਜਿੱਥੇ ਵੀ ਕਿਤੇ ਇੱਦਾਂ ਬਾਲ ਮਜ਼ਦੂਰੀ ਕਰਦਾ ਕੋਈ ਬੱਚਾ ਦਿਖਦਾ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਜੇ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਤਾਂ ਉਸਨੂੰ ਮਨ੍ਹਾ ਕਰਨਾ ਚਾਹੀਦਾ ਹੈ ਅਤੇ ਮਨ੍ਹਾ ਨਾ ਕਰਨ 'ਤੇ ਵੀ ਉਹ ਰੁਕੇ ਨਾ ਤਾਂ ਸਾਨੂੰ ਉਸਦੀ ਨੇੜਲੇ ਪੁਲਿਸ ਸਟੇਸ਼ਨ 'ਚ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਉਸ ਬੱਚੇ ਦਾ ਭਵਿੱਖ ਸੁਧਰ ਸਕੇ ਧੰਨਵਾਦ